ਹਾਂ ਸਾਡੇ ਸਕੂਲ ਵਿੱਚ ਲਾਈਬ੍ਰੇਰੀ ਸੀ ਜਿਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਸ਼ਾਮਿਲ ਸਨ ਮੈਂ ਬਚਪਨ 'ਚ ਹੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਜਿਹਦੇ ਵਿੱਚ ਕਵਿਤਾਵਾਂ ਚੁਟਕਲੇ ਬੁਝਾਰਤਾਂ ਅਤੇ ਮਿੰਨੀ ਕਹਾਣੀਆਂ ਵਾਲੀਆਂ ਕਿਤਾਬਾਂ ਸ਼ਾਮਿਲ ਸਨ ਜਦੋਂ ਮੈਂ ਇਹ ਕਿਤਾਬਾਂ ਪੜ੍ਹਦੀ ਸੀ ਤਾਂ ਹੌਲੀ ਹੌਲੀ ਮੇਰੇ ਅੰਦਰ ਦਿਲਚਸਪੀ ਵਧਣ ਲੱਗੀ ਕਿਤਾਬਾਂ ਪੜ੍ਹਨ ਦੀ ਅਤੇ ਇਸ ਤੋਂ ਬਾਅਦ ਮੈਂ ਨੌਵੀਂ ਦਸਵੀਂ 'ਚ ਮੈਨੂੰ ਯਾਦ ਹੈ ਮੈਂ ਪਾਸ਼ ਦੀ ਸੁਰਜੀਤ ਪਾਤਰ ਦੀ ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਜਿਹਦੇ ਨਾਲ ਮੈਨੂੰ ਲੱਗਿਆ ਵੀ ਮੇਰੀ ਸੋਚ ਪੂਰੀ ਤਰੀ ਬਦਲ ਗਈ ਅਤੇ ਮੈਨੂੰ ਨਾ ਐਂ ਲੱਗਿਆ ਵੀ ਜਿਵੇਂ ਇਹਨਾਂ ਨੇ ਮੇਰੀ ਸ਼ਖਸੀਅਤ ਨੂੰ ਹੋਰ ਨਿਖ਼ਾਰ ਦਿੱਤਾ ਅਤੇ ਮੈਂ ਹੋਰ ਡੁੰਘਾਈ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਜ਼ਿੰਦਗੀ ਬਾਰੇ ਅਤੇ ਮੈਨੂੰ ਇੰਨਾ ਕੁ ਜ਼ਿਆਦਾ ਵਧੀਆ ਲੱਗਿਆ ਅਤੇ ਮੈਂ ਸੋਚਿਆ ਵੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਕਦੇ ਵੀ ਮਰਨਾ ਨਹੀਂ ਚਾਹੀਦਾ ਮੈਂ ਇਹ ਆਪਣਾ ਸ਼ੌਂਕ ਹੁਣ ਤੱਕ ਕੌਂਟੀਨਿਊ ਰੱਖਿਆ ਹੋਇਆ ਅਤੇ ਕਿਤਾਬਾਂ ਮੈਂ ਬਚਪਨ ਦੇ ਵਿੱਚ ਜੋ ਇੰਨੀਆਂ ਪੜ੍ਹੀਆਂ ਮੈਨੂੰ ਲੱਗਦਾ ਵੀ ਉਹਨਾਂ ਕਿਤਾਬਾਂ ਦੀ ਬਦੌਲਤ ਅੱਜ ਜਿਹੜੀ ਮੇਰੀ ਸਖਸ਼ੀਅਤ ਹੈ ਉਹ ਐਵੇਂ ਦੀ ਹੋਈ ਹੈ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ ਪਰ ਵੀ ਜੋ ਕਿਤਾਬਾਂ ਆਪਣੇ ਪਰਸਨੈਲਿਟੀ ਨੂੰ ਨਿਖਾਰਦੀਆਂ ਨੇ ਆਪਣੇ ਜ਼ਿੰਦਗੀ ਬਾਰੇ ਦੱਸਦੀਆਂ ਨੇ ਡੁੰਘਾਈ ਦੇ ਵਿੱਚ ਉਹ ਕਿਤਾਬਾਂ ਪੜ੍ਹਨੀਆਂ ਮੈਂ ਬਹੁਤ ਪ੍ਰੈਫਰ ਕਰਦੀ ਹਾਂ ਬਚਪਨ ਦੇ ਵਿੱਚ ਵੀ ਮੈਂ ਉਵੇਂ ਦੀ ਹੀ ਕਿਤਾਬਾਂ ਪੜ੍ਹਦੀ ਸੀ ਜਿਹੜੀਆਂ ਕਿਸੇ ਦੀ ਸੱਚੀ ਕਹਾਣੀ 'ਤੇ ਅਧਾਰਿਤ ਹੁੰਦੀਆਂ ਸਨ ਅਤੇ ਕਿਸੇ ਨੇ ਬਹੁਤ ਮਿਹਨਤ ਕਰਕੇ ਅੱਗੇ ਤੱਕ ਆਏ ਅਤੇ ਉਹ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਤੌਰ 'ਤੇ ਉਹਨਾਂ ਦਾ ਜਿਹੜਾ ਪ੍ਰਯੋਗ ਕਰਦੇ ਹਾਂ ਤਾਂ ਮੈਨੂੰ ਵਧੀਆ ਲੱਗਦਾ ਸੀ ਕਿਤਾਬਾਂ ਪੜ੍ਹਨਾ ਹੁਣ ਵੀ ਮੈਂ ਸੋਚਦੀ ਹਾਂ ਵੀ ਅੱਗੇ ਇਸ ਸ਼ੌਂਕ ਨੂੰ ਬਰਕਰਾਰ ਰੱਖੂੰਗੇ